ਸਤਿ ਸ਼੍ਰੀ ਅਕਾਲ ਤੁਸੀਂ ਮੋਹਾਲੀ ਦੇ ਗਾਈਡਨੈਸ ਬੋਲਦੇ ਹੋ ਮੈਂ ਦਿੱਲੀ ਤੋਂ ਗੱਲ ਕਰ ਰਿਹਾ ਮੈਂ ਨਾ ਐਕਚੁਅਲੀ ਮੋਹਾਲੀ ਆਇਆ ਹੋਇਆ ਸੀਗਾ ਘੁੰਮਣ ਮੋਹਾਲੀ ਚੰਡੀਗੜ੍ਹ ਤੁਸੀਂ ਮੈਨੂੰ ਵਧੀਆ ਪਲੇਸ ਦੱਸ ਸਕਦੇ ਹੋ ਘੁੰਮਣ ਦਾ ਜੀ ਇੱਥੇ ਓਕੇ ਜਿੱਥੇ ਮਰਜ਼ੀ ਕੋਈ ਵੀ ਵਧੀਆ ਪਲੇਸ ਹੋਵੇ ਜਿਵੇਂ ਮੋਲ ਹੋ ਗਏ ਮੋਲ ਕਿਹੜੇ ਕਿਹੜੇ ਹੈ ਓਕੇ ਓਕੇ ਓਕੇ ਮੰਦਿਰ ਵਗੈਰਾ ਓਕੇ ਅਤੇ ਲੇਕ ਸੁਖਨਾ ਲੇਕ ਓਕੇ ਜੀ ਓਕੇ ਅਤੇ ਬਸ ਮੈਂ ਤੁਹਾਨੂੰ ਨਾ ਕਦੋਂ ਕੱਲ੍ਹ ਪਰਸੋਂ ਨੂੰ ਆਉਣਾ ਹੈ ਤਾਂ ਮੈਨੂੰ ਤੁਹਾਡੀ ਹੈਲਪ ਹੋਈ ਤਾਂ ਮੈਂ ਤੁਹਾਨੂੰ ਕੋਲ ਕਰ ਲਵਾਂਗਾ ਨੰਬਰ ਸੇਵ ਕਰ ਲੈਂਦਾ ਮੈਂ ਤੁਹਾਡਾ ਬਾਕੀ ਹਾਂਜੀ ਹਾਂ ਮੈਂ ਤੁਹਾਨੂੰ ਕੋਲ ਕਰ ਲਵਾਂਗਾ ਓਕੇ ਜੀ